ਅਸੀਂ ਜਦੋਂ ਵੀ ਰਸੋਈ ਦਾ ਨਵਾਂ ਪਕਵਾਨ ਬਣਾਉਣਾ ਸਿੱਖਦੇ ਹਾਂ ਤਾਂ ਸਭ ਤੋਂ ਪਹਿਲਾਂ ਇਹ ਸੋਚਦੇ ਹਾਂ ਕਿ ਸਾਨੂੰ ਕੋਈ ਵਧੀਆ ਜਿਹੀ ਰੈਸਪੀ ਮਿਲ ਜਾਵੇ ਜਿਵੇਂ ਕਿ ਸਾਨੂੰ ਹੁਣ ਸਾਰਿਆਂ ਦੇ ਟੈਕਨੋਲੋਜੀ ਦੇ ਜ਼ਮਾਨੇ ਕਰਕੇ ਜਿਸ ਤਰ੍ਹਾਂ ਅੱਜ ਕੱਲ੍ਹ ਸਾਰਿਆਂ ਦੇ ਕੋਲ ਵੱਡੇ ਫੋਨ ਟੱਚ ਸਨ ਜਿਹਦੇ ਨਾਲ ਅਸੀਂ ਯੂਟਿਊਬ 'ਤੇ ਵਧੀਆ ਰੈਸਪੀ ਦੇਖ ਸਕਦੇ ਹਾਂ ਹਰ ਇੱਕ ਚੀਜ਼ ਦੀ ਹਰ ਇੱਕ ਚੀਜ਼ ਬਣਾਉਣਾ ਸਿੱਖ ਸਕਦੇ ਹਾਂ ਸਾਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਂਦੀ ਹੈ ਜਿਵੇਂ ਕਿ ਅਸੀਂ ਕਿਤੇ ਵੀ ਬਾਹਰ ਚੱਲ ਜਾਈਏ ਜਾਂ ਬਾਹਰਲੇ ਕੰਟਰੀ 'ਚ ਚੱਲ ਜਾਈਏ ਜਾਂ ਕਿਤੇ ਵੀ ਹੋਰ ਚੱਲ ਜਾਈਏ ਆਪਣੇ ਵਾਸਤੇ ਕੁਝ ਵੀ ਰੈਸਪੀ ਬਣਾਉਣੀ ਹੋਵੇ ਤਾਂ ਅਸੀਂ ਸਭ ਤੋਂ ਪਹਿਲਾਂ ਯੂਟਿਊਬ ਤੋਂ ਦੇਖਦੇ ਹਾਂ ਯੂਟਿਊਬ ਚੈੱਕ ਕਰਦੇ ਹਾਂ ਜਿਹਦੇ ਵਿੱਚ ਸਾਨੂੰ ਅਲੱਗ ਅਲੱਗ ਤਰ੍ਹਾਂ ਦੇ ਲੋਕ ਮਿਲਦੇ ਸਨ ਚੈਨਲ ਹੁੰਦੇ ਸਨ ਜਿਹਦੇ ਵਿੱਚ ਸਾਨੂੰ ਖਾਣਾ ਬਣਾਉਣਾ ਵਾਸਤੇ ਸਿਖਾਇਆ ਜਾਂਦਾ ਹੈ ਹਰ ਇੱਕ ਤਰ੍ਹਾਂ ਦੀ ਸਬਜ਼ੀ ਜਿਹਦੇ ਵਿੱਚ ਚਟਨੀ ਤੋਂ ਲੈ ਕੇ ਵਧੀਆ ਬ੍ਰੈਂਡ ਕੁਆਲਿਟੀ ਦੇ ਸ਼ਾਹੀ ਪਨੀਰ ਤੱਕ ਹਰ ਇੱਕ ਤ ਪ੍ਰਕਾਰ ਦੀ ਰੈਸਪੀ ਹੁੰਦੀ ਹੈ ਜਿਹਦੇ ਵਿੱਚ ਸਾਨੂੰ ਬਣਾਉਣਾ ਸਿਖਾਉਂਦੇ ਸਨ ਉਹਦੇ ਵਿੱਚ ਵਧੀਆ ਕਿਹੜੇ ਬ੍ਰੈਂਡ ਦੇ ਉਹ ਮਸਾਲੇ ਯੂਜ਼ ਕਰਦੇ ਸਨ ਉਹ ਵੀ ਦੱਸਦੇ ਸਨ ਸਭ ਤੋਂ ਪਹਿਲਾਂ ਜਿਹੜਾ ਸਫ਼ਾਈ ਦਾ ਕੰਮ ਦੱਸਿਆ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਸਾਨੂੰ ਆਪਣੀ ਸਫ਼ਾਈ ਰੱਖ ਕੇ ਕਿਵੇਂ ਮਤਲਬ ਸਿਰਫ਼ ਕਿਚਨ ਦੀ ਸਫ਼ਾਈ ਰੱਖ ਕੇ ਕਿਵੇਂ ਰੈਸਪੀ ਬਣਾਉਣੀ ਸਿਖਾਉਂਦੇ ਸਨ ਕਿ ਇੱਦਾਂ ਮਤਲਬ ਪਹਿਲਾਂ ਕਿਹੜੇ ਮਸਾਲੇ ਯੂਜ਼ ਕਰਦੇ ਸਨ ਫਿਰ ਕਿਹੜੇ ਮਸਾਲੇ ਯੂਜ਼ ਕਰਦੇ ਸਨ ਫਿਰ ਕਿਵੇਂ ਸਾਨੂੰ ਸਬਜ਼ੀ ਬਣਾਉਣੀ ਸਿਖਾਉਂਦੇ ਸਨ ਕੋਈ ਵੀ ਰੈਸਪੀ ਸਬਜ਼ੀ ਬਣਾਉਣਾ ਰੋਟੀ ਬਣਾਉਣਾ ਚਟਨੀ ਬਣਾਉਣਾ ਚਾਵਲ ਬਣਾਉਣਾ ਚਿੱਕਨ ਬਣਾਉਣਾ ਆਦਿ ਸਾਰਾ ਕੁਛ ਸਾਨੂੰ ਯੂਟਿਊਬ ਦੇ ਵਿੱਚੋਂ ਹੀ ਮਿਲ ਜਾਂਦਾ ਹੈ ਜਿਹਦੇ ਵਿੱਚ ਅਸੀਂ ਸਾਰਾ ਕੁਝ ਉਹਦੇ ਤੋਂ ਸਿੱਖਦੇ ਹਾਂ ਆਪਣੇ ਵਾਸਤੇ ਆ ਕੁਝ ਵੀ ਬਣਾ ਕੇ ਖਾ ਸਕਦੇ ਹਾਂ ਕੁਝ ਵੀ ਆਪਣੇ ਆਪ ਨੂੰ ਮਤਲਬ ਕੁਝ ਵੀ ਅਸੀਂ ਮੈਗੀ ਬਣਾਉਣੀ ਆ ਉਹ ਵੀ ਸਾਨੂੰ ਯੂਟਿਊਬ ਤੋਂ ਹੀ ਮਿਲ ਜਾਂਦੀ ਉਹਦੀ ਰੈਸਪੀ ਵੀ ਅਸੀਂ ਯੂਟਊਬ ਤੋਂ ਹੀ ਬਣਾ ਕੇ ਖਾ ਸਕਦੇ ਹਾਂ ਹਰ ਇੱਕ ਚੈਨਲ ਹਰ ਇੱਕ ਲੋਕਾਂ ਨੇ ਆਪਣੇ ਆਪਣੇ ਚੈਨਲ ਖੋਲ੍ਹੇ ਹੋਏ ਜਿਹਦੇ ਵਿੱਚ ਅਸੀਂ ਕਿਸੇ ਦਾ ਵੀ ਨਾ ਭਰ ਕੇ ਉੱਪਰ ਆਪਣੇ ਚੈਨਲ ਮਤਲਬ ਉੱਤੋਂ ਰੈਸਪੀ ਪੜ੍ਹ ਸਕਦੇ ਹਾਂ ਅਤੇ ਆਪਣੇ ਵਾਸਤੇ ਕੁਝ ਵੀ ਬਣਾ ਕੇ ਖਾ ਸਕਦੇ ਹਾਂ ਥੈਂਕ ਯੂ